ਗਾਉਣ ਵਾਲੇ ਸਾਜ਼ਾਂ ਦੇ ਨਾਂ ਹਨ ਢੋਲ ਢੋਲ ਚਿੱਮਟਾ ਗਿਟਾਰ ਬਹੁਤ ਹੀ ਇਹਨਾਂ ਵਿੱਚੋਂ ਮੈਨੂੰ ਗਿਟਾਰ ਬਹੁਤ ਹੀ ਵਧੀਆ ਲੱਗਦਾ ਹੈ ਜੋ ਕਿ ਮੈਂ ਬਹੁਤ ਹੀ ਵਧੀਆ ਤਰੀਕੇ ਨਾਲ ਵਜਾਉਂਦਾ ਵਾ ਅਤੇ ਮੈਨੂੰ ਢੋਲ ਵੀ ਬਹੁਤ ਵਧੀਆ ਲੱਗਦਾ ਹੈ ਜੋ ਕਿ ਮੈਂ ਹਰੇਕ ਤਰ੍ਹਾਂ ਦਾ ਢੋਲ ਵਜਾਉਂਦਾ ਹਾਂ ਪੰਜਾਬੀ ਗਿੱਧਿਆਂ ਅਤੇ ਹਰੇਕ ਢੋਲ ਤਰ੍ਹਾਂ ਦਾ ਵਜਾ ਲੈਂਦਾ ਹਾਂ ਇਸ ਕਰਕੇ ਮੈਨੂੰ ਢੋਲ ਵੀ ਆਉਂਦਾ ਹੈ ਵਜਾਉਣਾ ਅਤੇ ਮੇਰਾ ਸਭ ਤੋਂ ਵਧੀਆ ਮੈਨੂੰ ਗਿਟਾਰ ਲੱਗਦਾ ਹੈ ਗਿਟਾਰ ਨਾਲ ਮੈਂ ਕਾਫ਼ੀ ਸਾਰੀਆਂ ਟਿਊਨਾਂ ਵੀ ਬਣਾਈਆਂ ਹਨ ਅਤੇ ਮੈਨੂੰ ਬਹੁਤ ਹੀ ਵਧੀਆ ਗਿਟਾਰ ਬਣਾ ਵਜਾਉਣਾ ਆਉਂਦਾ ਹੈ ਇਸ ਕਰਕੇ ਗਿਟਾਰ ਨਾਲ ਮੇਰਾ ਬਹੁਤ ਏ ਜ਼ਿਆਦਾ ਪਿਆਰ ਹੈ ਗਿਟਾਰ ਮੈਂ ਲਿਆ ਵੀ ਹੈ ਮੇਰੇ ਕੋਲ ਵੀ ਹੈ ਗਿਟਾਰ ਠੀਕ ਹੈ ਜੀ ਮੈਂ ਆਪਣਾ ਗਿਟਾਰ ਨਾਲ ਬਹੁਤ ਹੀ ਸਾਰੇ ਗਾਣਿਆ ਨਾਲ ਸਿੰਗਿੰਗ ਕਰਦਾ ਹਾਂ ਗਿਟਾਰ ਮੈਨੂੰ ਬਹੁਤ ਹੀ ਜ਼ਿਆਦਾ ਪਸੰਦ ਹੈ ਗਿਟਾਰ ਨਾਲ ਮੈਂ ਬਹੁਤ ਹੀ ਸਾਰੇ ਮਿਊਜ਼ਿਕ ਤਿਆਰ ਕੀਤੇ ਹਨ ਗਿਟਾਰ ਨਾਲ ਮੈਂ ਸ ਪ੍ਰੋਗਰਾਮ ਵੀ ਲਾਉਣ ਜਾਂਦਾ ਹਾਂ ਜੋ ਕਿ ਮੈਨੂੰ ਬਹੁਤ ਹੀ ਵਧੀਆ ਲੱਗਦਾ ਹੈ